ਹਾਂਜੀ ਜੀ ਜੀ ਜੀ ਜੀ ਬੋਲੋ ਜੀ ਹੈਗੇ ਹੈ ਜੀ ਬਿਲਕੁਲ ਜੀ ਏਸੀ ਦਾ ਵੱਖਰਾ ਹੈ ਜੀ ਅਤੇ ਨੋਨ ਏਸੀ ਵੱਖਰਾ ਹੈ ਵਧੀਆ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਕਿੰਨੇ ਕਿੰਨੇ ਦਿਨ ਲਈ ਚਾਹੀਦਾ ਜੀ ਓਕੇ ਜੀ ਨੋਨ ਏਸੀ ਦਾ ਪਵੇਗਾ ਜੀ ਤਿੰਨ ਸੌ ਰੁਪਇਆ ਪਰ ਡੇ ਏਸੀ ਵਾਲਾ ਲਉਂਗੇ ਤਾਂ ਸੱਤ ਸੌ ਰੁਪਈਆ ਪਰ ਡੇ ਆਧਾਰ ਆਧਾਰ ਕਾਰਡ ਭੇਜ ਦਿਉ ਜੀ ਇਸ ਨੰਬਰ 'ਤੇ ਠੀਕ ਹੈ ਜੀ ਕਿੰਨੇ ਪਰਸਨ ਹੈ ਉਹ ਲਿਖ ਕੇ ਭੇਜ ਦਿਉ ਪੇਅਮੈਂਟ ਔਨਲਾਇਨ ਵੀ ਕਰ ਸਕਦੇ ਹੋ ਆ ਕੇ ਵੀ ਪਹਿਲੇ ਦਿਨ ਕਰ ਸਕਦੇ ਹੋ ਕੋਈ ਗੱਲ ਨਹੀਂ ਹੈ ਪੰਜ ਚਾਰ ਪੰਜ ਕਿਲੋਮੀਟਰ ਅੱਗੇ ਜਾ ਕੇ ਫੇਰ ਹੈ ਹਾਂਜੀ ਜੀ ਬੱਸ ਸਰਵਿਸ ਵੀ ਹੈ ਜੀ ਆਟੋ ਸਰਵਿਸ ਵੀ ਹੈ ਛੇ ਸੱਠ ਜੀ ਓਕੇ ਜੀ ਓਕੇ ਓਕੇ ਓਕੇ ਨਾਂ ਨਾਮ ਵਗੈਰਾ ਨਾਮ ਵਗੈਰਾ ਲਿਖ ਕੇ ਭੇਜ ਦਿਉ ਵੈਲਕਮ ਓਕ ਜੀ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ